ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਸਰ ਹਾਂਜੀ ਮੂੰਗੀ ਬੀਜੀ ਨੂੰ ਤੁਹਾਡੇ ਕਿੰਨੇ ਚਿਰ ਹੋ ਗਿਆ ਸਰ ਕਿੰਨੇ ਚਿਰ ਦੀ ਹੋ ਗਈ ਹੈ ਦੋ ਕੁ ਮਹੀਨਿਆਂ ਦੀ ਇਹ ਤੋਂ ਪਹਿਲਾਂ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਖਾਦ ਕੋਈ ਪਹਿਲਾਂ ਕੁਛ ਪਾਇਆ ਕਿ ਨਹੀਂ ਜੀ ਹਾਂਜੀ ਓਕੇ ਸਪਰੇ ਕੀਤੀ ਹੁਣ ਤੁਹਾਡੀ ਮੂੰਗੀ ਦੀ ਫ਼ਸਲ ਨੂੰ ਕਿਸੇ ਤਰ੍ਹਾਂ ਦਾ ਕੋਈ ਕੀੜਾ ਜਾਂ ਕੁਛ ਹੋਰ ਲੱਗਿਆ ਹੋਇਆ ਜਾਂ ਬਿਲਕੁਲ ਸਹੀ ਆ ਮੈਂ ਉਸ ਅਕੌਰਡਿੰਗ ਤੁਹਾਨੂੰ ਗੱਲ ਦੱਸਾਂ ਓਕੇ ਕ ਉਹਦੇ ਬਾਰੇ ਪਹਿਲਾਂ ਮੈਨੂੰ ਇਹ ਦੱਸੋਗੇ ਤੁਹਾਡੀ ਜਿਹੜੀ ਜ਼ਮੀਨ ਹੈ ਉਹਦੀ ਜ਼ਮੀਨ ਦੀ ਨਮੀਂ ਬਾਰੇ ਤੁਸੀਂ ਕੁਛ ਕੀਤਾ ਨਮੀਂ ਕਢਵਾਈ ਸੀ ਨਮੀਂ ਕਿੰਨੀ ਹੈ ਖੁਸ਼ਕ ਆ ਜਾਂ ਨਮੀਂ ਜ਼ਿਆਦਾ ਵਾ ਸੈਵਨ ਪੋਆਇੰਟ ਫਾਈਵ ਠੀਕ ਹੈ ਸਰ ਉਸ ਅਕੋਰਡਿੰਗ ਤੁਸੀਂ ਤੁਹਾਡੀ ਜਾਣੀ ਕਿ ਮੂੰਗੀ ਦੀ ਫ਼ਸਲ ਥੋੜ੍ਹੀ ਮੁਰਝਾਈ ਵੀ ਹੈ ਪੱਤੇ ਪੀਲੇ ਪੈ ਰਹੇ ਆ ਕੁਛ ਹੋਰ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਓਕੇ ਓਕੇ ਓਕੇ ਓਕੇ ਸਰ ਇਹਦੇ ਵਾਸਤੇ ਤੁਸੀਂ ਜੀ ਇਹਦੀ ਥੋੜ੍ਹੀ ਜਿਹੀ ਦੀ ਲੋੜ ਹੈ ਇਹਦੇ ਵਾਸਤੇ ਤੁਸੀਂ ਦੇਸੀ ਰੇਹ ਯੂਜ ਕਰ ਸਕਦੇ ਓਂ ਜਾਂ ਫਿਰ ਸਾਡੇ ਤੁਸੀਂ ਸ਼ੋਰੂਮਸ ਆਉਂਗੇ ਸ਼ੋਪ 'ਤੇ ਸ਼ੋਪ 'ਤੇ ਤੁਹਾਨੂੰ ਮੈਂ ਦੋ ਤਿੰਨ ਕੰਪਨੀਆਂ ਦੀ ਹੋਏਗੀ ਪੈਸਟੀਸਾਈਡ ਜਿਹੜੀ ਕਿ ਬਹੁਤ ਵਧੀਆ ਉਹਦੇ ਨਾਲ ਤੁਹਾਡੀ ਫਸਲ ਨੂੰ ਬਿਲਕੁਲ ਸਹੀ ਹੋਊ ਰਹੇਗੀ ਥੋੜ੍ਹੀ ਮੁਰਝਾਈ ਜਿਹੜੀ ਉਹ ਸੈਟ ਹੋ ਜਾਵੇਗੀ ਨਾਲੇ ਇਹਨਾਂ ਦਾ ਜਿਹੜਾ ਝਾੜ ਵੀ ਜ਼ਿਆਦਾ ਆਵੇਗਾ ਹਾਂਜੀ ਇਹ ਤੁਸੀਂ ਸਰ ਦੋ ਏਕੜ 'ਚ ਲਗਾਈ ਆ ਇੱਕ ਏਕੜ ਦੇ ਵਿੱਚ ਤਕਰੀਬਨ ਤੁਸੀਂ ਲਗਾ ਲਓ ਦੋ ਕੁ ਲੀਟਰ ਪਵੇਗੀ ਦੋ ਕੁ ਲੀਟਰ ਦਾ ਖਰਚਾ ਤਕਰੀਬਨ ਸਾਢੇ ਕੁ ਪੰਜ ਸੌ ਰੁਪਈਆ ਹੋਵੇਗਾ ਸਰ ਹਾਂ ਹਾਂਜੀ ਓਕੇ ਹਾਂਜੀ ਸਾਡੀ ਸ਼ੋਪ ਸੁਭਾ ਅੱਠ ਵਜੇ ਤੋਂ ਲੈ ਕੇ ਰਾਤ ਅੱਠ ਵਜੇ ਤੱਕ ਖੁੱਲ੍ਹੀ ਹੁੰਦੀ ਹੈ ਜਿਸ ਟਾਈਮ ਮਰਜ਼ੀ ਆ ਸਕਦੇ ਹੋ ਜੀ ਓਕੇ ਸਰ ਥੈਂਕ ਯੂ ਜੀ